ਹਾਂਜੀ ਸਾਨੂੰ ਇਤਿਹਾਸ ਪੜ੍ਹਾਉਣਾ ਅਤੇ ਪੜ੍ਹਨਾ ਬਹੁਤ ਜ਼ਰੂਰੀ ਹੈ ਜੋ ਕਿ ਸਾਨੂੰ ਜੋ ਵੀ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਸਾਡੇ ਸਾਡੇ ਕਰਕੇ ਉਹ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਅੱਗੇ ਵੀ ਬੱਚਿਆਂ ਨੂੰ ਇਤਿਹਾਸਿਕ ਦੱਸਣਾ ਬਹੁਤ ਜ਼ਰੂਰੀ ਹੈ ਜਿੱਦਾਂ ਕਿ ਦੋ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਿੱਚ ਵਜ਼ੀਰ ਖਾਨ ਨੇ ਜੀਂਦੇ ਹੀ ਕੰਧਾਂ ਵਿੱਚ ਚਿਣ ਦਿੱਤਾ ਗਿਆ ਸੀ ਅਤੇ ਇੱਦਾਂ ਵੀ ਕਈ ਗੁਰੂਆਂ ਨੇ ਸਾਡੇ ਲਈ ਬਹੁਤ ਬਹੁਤ ਕੁਰਬਾਨੀ ਦਿੱਤੀਆਂ ਨੇ ਅਤੇ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਿੰਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ